ਹੈਲੋ ਹਾਂਜੀ ਕੌਣ ਸਤਿ ਸ਼੍ਰੀ ਆਕਾਲ ਜੀ ਤੁਸੀਂ ਕੌਣ ਹਾਂਜੀ ਮੈਂ ਕੋਚ ਦੀ ਟ੍ਰੇਨਿੰਗ ਦਿੰਦੀ ਹਾਂ ਹਾਂਜੀ ਹਾਂਜੀ ਹਾਂਜੀ ਜ਼ਰੂਰ ਕੋਈ ਗੱਲ ਨਹੀਂ ਤੁਸੀਂ ਕਦੋਂ ਮਰਜ਼ੀ ਆ ਸਕਦੇ ਹੋ ਹਾਂਜੀ ਹਾਂਜੀ ਜ਼ਰੂਰ ਜਦੋਂ ਮਰਜ਼ੀ ਤੁਸੀਂ ਮੇਰੇ ਕੋਲ ਆ ਸਕਦੇ ਹੋ ਜਦੋਂ ਮਰਜੀ ਅ ਤੁਸੀਂ ਆ ਕੇ ਸਿੱਖ ਸਕਦੇ ਹੋ ਐਡਰੈਸ ਹੈ ਨਾ ਅ ਤਾਂ ਆਪਾਂ ਮੰਡੀ ਵਿੱਚ ਜਿਹੜਾ ਬਾਲਮੀਕ ਚੌਂਕ ਆ ਉੱਥੇ ਗਰਾਊਂਡ ਵਿੱਚ ਮੈਂ ਕਰਵਾਉਂਦੀ ਹਾਂ ਫੀਸ ਮਹੀਨੇ ਦੀ ਅ ਨਾ ਦੋ ਹਜ਼ਾਰ ਰੁਪਏ ਆ ਟਾਈਮ ਤੁਸੀਂ ਸਵੇਰੇ ਛੇ ਵਜੇ ਤੋਂ ਆ ਸਕਦੇ ਹੋ ਹਾਂਜੀ ਹਾਂਜੀ ਤੁਸੀਂ ਅ ਹੋਰ ਕ ਕੁਛ ਵੀ ਕਰਨਾ ਚਾਹੁੰਦੇ ਹੋ

ਅੱਛਾ ਅੱਛਾ ਹਾਂਜੀ ਹਾਂਜੀ ਸਭ ਕੁਝ ਹੁੰਦਾ ਹਾਂਜੀ ਕੋਈ ਗੱਲ ਨਹੀਂ ਇਹਦੇ ਵਾਸਤੇ ਪੰ ਪੰਜ ਸੌ ਰੁਪਿਆ ਹੋਰ ਹੈ ਜੀ ਜਿਮ ਵਾਸਤੇ ਹਾਂਜੀ ਹਾਂਜੀ ਹਾ ਹਾਂਜੀ ਕੋਈ ਗੱਲ ਨਹੀਂ ਸਾਰਾ ਕੁਛ ਹੀ ਕਰਵਾ ਦਿੰਦੀ ਹਾਂ ਮੈਂ ਹਾਂਜੀ ਇੱਥੇ ਅ ਖੋ ਖੋ ਦੀ ਪ੍ਰੈਕਟਿਸ ਵੀ ਹੁੰਦੀ ਆ ਸਾਰੀਆਂ ਸਪੋਰਟਸ ਜੀ ਮੈਂ ਕਰਾ ਦਿੰਦੀ ਹਾਂ ਹਾਂਜੀ ਹਾਂਜੀ ਸੇਢੇ ਸਾਢੇ ਛੇ ਨਹੀਂ ਜੀ ਛੇ ਵਜੇ

ਹਾਂਜੀ ਹਾਂਜੀ ਓਵਰ ਹਾਂਜੀ ਓਵਰ ਟਾਈਮ ਵੀ ਲਾ ਸਕਦੇ ਹੋ ਹਾਂਜੀ ਓਕੇ ਤੁਸੀਂ ਕੱਲ੍ਹ ਤੋਂ ਆ ਸਕਦੇ ਹੋ ਹਾਂਜੀ ਹਾਂਜੀ ਓਕੇ